ਸਾਡੇ ਇਲਾਕੇ ਦੇ ਕਈ ਵਹਿਮ ਭਰਮ ਹੈ ਤੁਸੀਂ ਇਲਾਕੇ ਨੂੰ ਛੱਡੋ ਸਭ ਤੋਂ ਪਹਿਲਾਂ ਆਪਾਂ ਘਰ ਦੀ ਹੀ ਗੱਲ ਕਰਦੇ ਹਾਂ ਜੇਕਰ ਸੁਬਹਾ ਸੁਬਹਾ ਘਰੋਂ ਨਿਕਲਦੇ ਹਾਂ ਨਿਕਲ ਕੇ ਜੇਕਰ ਸਾਨੂੰ ਕੋਈ ਖਾਲੀ ਭਾਂਡਾ ਲੈ ਕੇ ਕੋਈ ਬੰਦਾ ਦਿਖਦਾ ਤਾਂ ਭਰਮ ਕਿ ਇਹ ਕਿੱਥੋਂ ਟੱਕਰ ਗਿਆ ਜੇਕਰ ਰਸਤੇ ਵਿੱਚ ਜਾਂਦੇ ਹੋਏ ਚੁਰਸਤੇ ਦੇ ਵਿੱਚ ਕੋਈ ਕਿਸੇ ਨੇ ਨਾਰੀਅਲ ਰੱਖਿਆ ਹੋਵੇ ਕਿਸੇ ਨੇ ਲਾਲ ਕੱਪੜਾ ਰੱਖਿਆ ਹੋਵੇ ਤਾਂ ਵੀ ਵਹਿਮ ਭਰਮ ਕਿਸੇ ਨੇ ਟੂਣਾ ਕਰਤਾ ਇਹ ਤਾਂ ਜਮਾਂ ਹੀ ਨਹੀਂ ਟੱਪਣਾ ਇਸ ਤੋਂ ਇਲਾਵਾ ਜੇਕਰ ਆਪਾਂ ਸ਼ੁਭ ਕੰਮ ਕਰਨ ਲਈ ਘਰੋਂ ਟ ਨਿਕਲਦੇ ਹਾਂ ਜੇਕਰ ਤੁਹਾਨੂੰ ਕੋਈ ਬਿੱਲੀ ਮਿਲ ਗਈ ਤੁਹਾਡਾ ਰਸਤਾ ਕੱਟ ਗਈ ਤਾਂ ਵੀ ਵਹਿਮ ਭਰਮ ਕਿ ਇਹ ਬਿੱਲੀ ਰਸਤਾ ਕਿਉਂ ਕੱਟ ਗਈ ਹੁਣ ਤਾਂ ਆਪਣਾ ਕੰਮ ਜਮਾਂ ਹੀ ਨਹੀਂ ਹੋਣਾ ਤੁਹਾਡਾ ਬਹੁਤ ਬਹੁਤ ਧੰਨਵਾਦ